ਸਾਲਾਂ ਦੌਰਾਨ ਉਹ ਪੰਜਾਬ ਦਾ ਮਨੋਰੰਜਨ ਦਾ ਦ੍ਰਿਸ਼ ਬਹੁਤ ਹੀ ਬਦਲ ਚੁੱਕਾ ਹੈ ਇਸ ਦੇ ਵਿੱਚ ਬਹੁਤ ਹੀ ਚੀਜ਼ਾਂ ਆਉਂਦੀਆਂ ਹਨ ਜਿਵੇਂ ਕਿ ਲੋਕ ਅੰਦਰੂਨੀ ਗੇਮਾਂ ਖੇਡਦੇ ਹਨ ਇੱਥੇ ਪਾਰਕਾਂ ਬਹੁਤ ਬਨ ਚੁੱਕੀਆਂ ਹਨ ਲੋਕ ਘੁੰਮਣਾ ਫਿਰਨਾ ਪਸੰਦ ਕਰਦੇ ਹਨ ਸਭ ਤੋਂ ਵੱਡੀ ਗੱਲ ਪੰਜਾਬ ਇੱਕ ਆਕਰਸ਼ਣ ਦਾ ਕੇਂਦਰ ਬਣ ਚੁੱਕਾ ਹੈ ਉਹ ਕਿਸ ਕਰਕੇ ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਜਿਵੇਂ ਕਿ ਇੱਥੇ ਸ਼੍ਰੀ ਦਰਬਾਰ ਸਾਹਿਬ ਜੀ ਉਸ ਨੂੰ ਵੇਖਣ ਵਾਸਤੇ ਲੋਕ ਬਾਹਰਲੀ ਕੰਟਰੀਆਂ 'ਚੋਂ ਵੀ ਆਉਂਦੇ ਹਨ ਅਤੇ ਲੋਕ ਘੱਟੋ ਇੱਥੇ ਜ਼ਿਆਦਾ ਅਤੇ ਉ ਬਾਹਰਲੇ ਵੀ ਜ਼ਿਆਦਾ ਸਭ ਜਿਆ ਜ਼ਿਆਦਾ ਜ਼ਿਆਦਾ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਹਨ ਪੰਜਾਬ ਵਿੱਚ ਐਸੀਆਂ ਹੋਰ ਵੀ ਬੜੀਆਂ ਥਾਵਾਂ ਹੁਣ ਬਣ ਚੁੱਕੀਆਂ ਹਨ ਜਿਹੜਾ ਕਿ ਆਕਰਸ਼ਣ ਦਾ ਕੇਂਦਰ ਬਣ ਚੁੱਕੀਆਂ ਹਨ ਨਵੀਆਂ ਨਵੀਆਂ ਪਾਰਕਾਂ ਖੁੱਲ੍ਹ ਚੁੱਕੀਆਂ ਹਨ ਜਿੱਥੇ ਕਿ ਬੱਚੇ ਪੂਰੀ ਤਰ੍ਹਾਂ ਆਨੰਦ ਮਾਣਦੇ ਆ ਅਤੇ ਵੱਡੇ ਵੀ ਆਨੰਦ ਮਾਣਦੇ ਆ ਬਹੁਤ ਹੀ ਹੋਰ ਵੀ ਬਹੁਤ ਤਰ੍ਹਾਂ ਦੀਆਂ ਖੇਡਾਂ ਵੀ ਆ ਚੁੱਕੀਆਂ ਹਨ ਜਿਸ ਨਾਲ ਪੰਜਾਬ ਦੇ ਬੱਚੇ ਬਹੁਤ ਹੀ ਜ਼ਿਆਦਾ ਆਨੰਦ ਮਾਣਦੇ ਹਨ ਇਹ ਆਕਰਸ਼ਣ ਦਾ ਕੇਂਦਰ ਦਿਨੋਂ ਦਿਨ ਬਣਦਾ ਜਾ ਰਿਹਾ ਹੈ ਅਤੇ ਮਨੋਰੰਜਨ ਦਾ ਦ੍ਰਿਸ਼ ਵੀ ਇਹ ਵੇਖਣ ਦਾ ਬਦਲਦਾ ਜਾ ਰਿਹਾ ਹੈ